ਹਾਂਜੀ ਮੈਂ ਸੁਨੀਤਾ ਬੋਲ ਰਹੀ ਹੂੰ ਬੋਲ ਰਹੀ ਹਾਂ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਪ੍ਰੋਪਰਟੀ ਡੀਲਰ ਦਾ ਕੰਮ ਹੈ ਆਪਣਾ ਹਾਂਜੀ ਦੱਸੋ ਹਾਂਜੀ ਤੁਹਾਨੂੰ ਜਗ੍ਹਾ ਚਾਹੀਦੀ ਹੈ ਜਾਂ ਬਣਿਆ ਬਣਾਇਆ ਘਰ ਚਾਹੀਦਾ ਬਨ ਲੋਕੇਸ਼ਨ ਕਿੱਦਾਂ ਦੀ ਚਾਹੀਦੀ ਹੈ ਅਤੇ ਘਰ ਕਿੰਨਾ ਕੁ ਵੱਡਾ ਹੋਵੇ ਅਤੇ ਉਹ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ ਅੱਛਾ ਨਹੀਂ ਨਹੀਂ ਲੋਕੇਸ਼ਨ ਕਿੱਧਰ ਦੀ ਚਾਹੀਦੀ ਹੈ ਜਿਵੇਂ ਗਣਪਤੀ ਜਾਂ ਇੱਧਰ ਜਿਵੇਂ ਕੀ ਕਹਿੰਦੇ ਆ ਗਰੀਨ ਸਿਟੀ ਅਵੈਨਿਊ ਹੈਗਾ ਇਹ ਕਿੱਧਰਲੀ ਸਾਈਡ ਮਤਲਬ ਲੋਕੇਸ਼ਨ ਕਿਹੜੀ ਚਾਹੀਦੀ ਹੈ ਜਾਂ ਸਿਟੀ ਦੇ ਵਿੱਚ ਚਾਹੀਦੇ ਆ ਆਊਟਰ 'ਤੇ ਵੀ ਚੱਲਜੂਗੀ

ਹਾਂ ਹਾਂ ਹਾਂ ਹਾਂ ਨਹੀਂ ਸ਼ੀਸ਼ ਮਹਿਲ ਦੇ ਵਿੱਚ ਤਾਂ ਪਲੋਟ ਤਾਂ ਹੈਗੇ ਆ ਜੇ ਤੁਸੀਂ ਆਪ ਬਣਾਉਣਾ ਤਾਂ ਹੁਣ ਤੁਸੀਂ ਆਪਣਾ ਘਰ ਹੈ ਜਾਂ ਰੈਂਟ 'ਤੇ ਆ ਤੁਹਾਡਾ ਫਿਰ ਉਹ ਸੇਲ ਵੀ ਕਰਨਾ ਅੱਛਾ ਅੱਛਾ ਪਹਿਲਾਂ ਤੁਸੀਂ ਪਰਚੇਸ ਕਰਨਾ ਠੀਕ ਹੈ ਅਤੇ ਤੁਹਾਨੂੰ ਫਿਰ ਕੋਈ ਗੱਲ ਨਹੀਂ ਤੁਸੀਂ ਕਦੋਂ ਵਿਹਲੇ ਹੋਓਂਗੇ ਸੈਟਰਡੇ ਨੂੰ ਫਰੀ ਹੋ ਤਾਂ ਸੈਟਰਡੇ ਨੂੰ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਆ ਜਾਓ ਅਤੇ ਮੈਂ ਤੁਹਾਨੂੰ ਦੋ ਤਿੰਨ ਜਗ੍ਹਾ ਘਰ ਦਿਖਾ ਦਊਗੀ ਮੋਡਲ ਟਾਊਨ 'ਚ ਵੀ ਦਿਖਾ ਦੂੰਗੀ ਅਤੇ ਇੱਥੇ ਗਣਪਤੀ 'ਚ ਵੀ ਸ਼ੀਸ਼ ਮਹਿਲ 'ਚ ਵੀ ਅਤੇ ਜਿਹੜਾ ਤੁਹਾਨੂੰ ਠੀਕ ਲੱਗੇ ਪਹਿਲਾਂ ਤੁਸੀਂ ਆਪਣੀ ਰਿਕੁਾਇਰਮੈਂਟ ਦੇ ਹਿਸਾਬ ਨਾਲ ਦੇਖ ਲਿਓ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਠੀਕ ਲੱਗੇ ਫਿਰ ਉਹਦੇ ਹਿਸਾਬ ਨਾਲ ਆਪਾਂ ਉਹਨਾਂ ਦੇ ਜਿਹੜੇ ਓਨਰ ਆ ਉਹਨਾਂ ਨਾਲ ਮੈਂ ਗੱਲ ਆਪੇ ਕਰ ਲੂੰਗੀ ਅਤੇ ਸਾਰਾ ਕੁਛ ਸੈੱਟ ਕਰਲੂੰਗੀ ਅਤੇ ਤੁਹਾਡੀ ਕਿੰਨੀ ਕੁ ਹੈਗੀ ਆ ਰੇਂਜ ਪੈਸਿਆਂ ਦੀ ਕਿੰਨੇ ਕੁ ਤੱਕ ਦਾ ਦੇਖਣਾ ਅੱਛਾ ਪੰਜਾਹ ਕੁ ਲੱਖ ਦਾ ਦੇਖਣਾ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਤਾ ਉਹ ਤਾਂ ਮਿਲ ਜੂਗਾ ਗਰਾਊਂਡ ਫਲੋਰ ਮਤਲਬ ਤੁਹਾਨੂੰ ਤਾਂ ਪੂਰਾ ਘਰ ਹੀ ਚਾਹੀਦਾ ਨਹੀਂ ਤੁਸੀਂ ਹੁਣ ਰੈਂਟ ਦੀ ਗੱਲ ਕਰ ਰਹੇ ਹੋ ਜਾਂ ਆਪਣਾ ਖਰੀਦਣ ਦੀ ਗੱਲ ਕਰ ਰਹੇ ਹੋ ਅੱਛਾ ਜਦੋਂ ਤੱਕ ਆਪਦਾ ਨਹੀਂ ਸੈੱਟ ਆਉਂਦਾ ਉਦੋਂ ਤੱਕ ਤੁਸੀਂ ਰੈਂਟ 'ਤੇ ਲੈ ਲਓਂਗੇ ਹੈਂ ਠੀਕ ਹੈ ਜੀ ਕੋਈ ਗੱਲ ਨਹੀਂ ਰੈਂਟ ਵਾਲੇ ਵੀ ਤੁਹਾਨੂੰ ਦਿਖਾ ਦਾਂਗੇ ਅਤੇ ਦੂਜਾ ਵੀ ਦਿਖਾ ਦਾਂਗੇ ਆਪਣਾ ਵੀ ਤੁਸੀਂ ਸੈਟਰਡੇ ਨੂੰ ਆ ਜਾਇਓ ਮੈਨੂੰ ਦੱਸ ਦਿਓ ਠੀਕ ਹੈ ਠੀਕ ਹੈ ਜੀ ਓਕੇ ਓਕੇ